ਸਕੂਲ ਅਤੇ ਕਾਲਜ ਦੇ ਵਿੱਚ ਸਾਇੰਸ ਪ੍ਰੋਜੈਕਟਾਂ 'ਤੇ ਬਹੁਤ ਸਾਰਾ ਕੰਮ ਕੀਤਾ ਹੈ ਸ ਜਦੋਂ ਵੀ ਸਕੂਲ ਦੇ ਵਿੱਚ ਸਾਇੰਸ ਐਗਜੀਬਿਸ਼ਨ ਲੱਗਦੀ ਸੀ ਤਾਂ ਮੈਂ ਕੋਈ ਨਾ ਕੋਈ ਪ੍ਰੋਜੈਕਟ ਬਣਾ ਕੇ ਜ਼ਰੂਰ ਪੇਸ਼ ਕਰਦੀ ਸੀ ਅਤੇ ਮੇਰਾ ਪ੍ਰੋਜੈਕਟ ਪਸੰਦ ਵੀ ਕੀਤਾ ਜਾਂਦਾ ਸੀ

ਇਹਨਾਂ ਪ੍ਰੋਜੈਕਟਾਂ ਦੇ ਵਿੱਚ ਕਈ ਵਾਰੀ ਮੈਂ ਐਗਰੀਕਲਚਰ 'ਤੇ ਅਤੇ ਕਈ ਵਾਰੀ ਮੈਂ ਟੈਕਨੋਲੋਜੀ 'ਤੇ ਪ੍ਰੋਜੈਕਟ ਬਣਾ ਲੈਂਦੀ ਸੀ